ਹਾਂ ਬਹੁਤ ਸਾਰੀਆਂ ਔਰਤਾਂ ਹਨ ਜਿਹੜੀਆਂ ਖੇਡਾਂ ਵਿੱਚ ਬਰਾਬਰ ਦਾ ਹਿੱਸਾ ਲੈਂਦੀਆਂ ਹਨ ਜਿਵੇਂ ਕਿ ਮੈਰੀ ਕੋਮ ਬੋਕਸਿੰਗ ਖੇਡਦੀ ਹੈ ਸਾਨੀਆਂ ਮਿਰਜ਼ਾ ਟਾਈਨਸ ਖੇਡਦੀ ਹੈ ਹਰਮਨਪ੍ਰੀਤ ਕੌਰ ਕ੍ਰਿਕਟ ਖੇਡਦੀ ਹੈ ਹੋਰ ਕਈ ਅਜਿਹੀਆਂ ਔਰਤਾਂ ਹ ਦੀਆਂ ਹਸਤੀਆਂ ਹਨ ਜੋ ਬਹੁਤ ਸਾਰੀਆਂ ਖੇਡਾਂ ਖੇਡਦੀਆਂ ਹਨ ਖੇਡਾਂ ਦੇ ਮੌਕੇ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਇਹਨਾਂ ਵਾਸਤੇ ਖੇਡਾਂ ਦੇ ਕੈਂਪ ਵੀ ਲਗਾਏ ਜਾਂਦੇ ਹਨ ਮੇਲਿਆਂ ਵਿੱਚ ਵੀ ਖੇਡਾਂ ਕਰਨ ਵਾਲੀਆਂ ਔਰਤਾਂ ਹੁੰਦੀਆਂ ਹਨ ਸਕੂਲ ਵਿੱਚ ਖੇਡ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਔਰਤਾਂ ਨੂੰ ਵੀ ਤਹਿਜੀਬ ਦਿੱਤੀ ਜਾਂਦੀ ਹੈ ਕਈ ਹੋਰ ਔਰਤਾਂ ਬਹੁਤ ਸਾਰੀਆਂ ਹਨ ਜੋ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਹਨ ਅਤੇ ਪੰਜਾਬ ਵਿੱਚ ਬਹੁਤ ਹੀ ਲੜਕੀਆਂ ਹਨ ਜਿਹੜੀਆਂ ਆਪਣਾ ਖੇਡਾਂ ਦੇ ਮੁਕਾਬਲੇ ਵਿੱਚ ਨਾਮ ਰੌਸ਼ਨ ਕੀਤਾ ਹੈ ਜਿਵੇਂ ਕਿ ਸਾਨੀਆਂ ਮਿਰਜ਼ਾ ਮੈਰੀ ਕੋਮ